ਹੈਲੋ ਕੌਣ ਬੋਲਦਾ ਬਲਦੇਵ ਮਿਸਤਰੀ ਬੋਲਦਾ ਤੇ ਅਸੀਂ ਨਾ ਬਾਈ ਆਪਣਾ ਨਾ ਬੈਡ ਬਣਵਾਉਣਾ ਡਬਲ ਬੈਡ ਢੋ ਸਣੇ ਬਣਾ ਦੋਗੇ ਤੁਸੀਂ ਹਾਂ ਸਾਈਜ ਤੇ ਜਿਹੜਾ ਛੇ ਬਾਈ ਛੇ ਦਾ ਸਾਈਜ਼ ਹੋਵੇ ਤੇ ਮਤਲਬ ਡੂੰਘਾ ਜਿਹੜਾ ਆ ਡੂੰਘਾ ਦੋ ਫੁੱਟ ਡੂੰਘਾ ਹੋਣਾ ਚਾਹੀਦਾ ਤੇ ਬਾਕੀ ਹੈ ਨਹੀ ਢੋ ਬਾਕੀ ਸਿੰਪਲ ਹੀ ਹੋਵੇ ਪਰ ਵਿੱਚ ਦਰਾਜ ਵਗੈਰਾ ਪਾ ਦੇਣ ਤੇ ਬਾਕੀ ਸਰਮੈਕਾ ਵਗੈਰਾ ਕਿਹੋ ਜਿਹੀ ਲੋਉਗੇ ਤੁਸੀਂ ਚਲੋ ਉਹ ਤਾਂ ਜਦੋਂ ਆਵਾਂਗੇ ਫਿਰ ਦੋ ਪਸੰਦ ਕਰ ਲਾਂਗੇ ਵੀ ਇਸੇ ਤੇ ਮੈਂ ਕੁਝ ਪਤਾ ਕਰ ਲਗੇ ਤੇ ਕਿੰਨੀ ਕ ਰੇਂਜ ਪੈ ਜਾਊਗਾ ਆਪਾਂ ਨੂੰ ਇਹ ਬਈ ਲੱਕੜ ਚੰਗੀ ਟਾਲੀ ਦੀ ਹੋਵੇ ਇਹ ਨਾ ਹੋਵੇ ਲੱਕੜ ਨੂੰ ਘੁਣ ਲੱਗ ਜਾਏ ਸਾਲ ਬਾਅਦ ਹਾਂ ਗੱਦਾ ਵੀ ਲਵਾਂਗੇ ਗੱਦੇ ਦੀ ਕੀਮਤ ਕੀ ਹੋਊਗੀ ਕਿੰਨੇ ਦਾ ਗੱਦਾ ਪੰਜ ਹਜ਼ਾਰ ਦਾ ਅੱਛਾ ਅੱਛਾ ਠੀਕ ਹੈ ਤੇ ਬਾਕੀ ਮਤਲਬ ਕਿ ਦੋ ਫੁੱਟ ਤੋਂ ਘੱਟ ਨਾ ਹੋਵੇ ਤੇ ਵਿੱਚ ਬਿਸਤਰਾ ਵਗੈਰਾ ਪੂਰਾ ਆ ਜਾਵੇ ਸਹੀ ਹਾ ਤੇ ਸਰਮਾਕਾ ਵਧਿਆ ਲਗਿਆ ਹੋਵੇ ਤੇ ਢੋ ਨੂ ਵੀ ਸਰਮਾਕਾ ਲਾ ਕੇ ਤੇ ਦਰਾਜ ਵਗੈਰਾ ਪਾ ਕੇ ਸੋਹਣਾ ਬਣਾ ਕੇ ਦਿਓ ਢੋ ਜਿਹੜੀ ਢੋ ਬਣੂਗੀ ਉਹਦੇ ਵਿੱਚ ਤਾਂ ਦਰਾਜ ਹੀ ਪੈਣਗੇ ਤੇ ਜਿਹੜੀ ਥੱਲੇ ਵਾਲਾ ਹੋ ਕੇ ਬੈਡ ਦੇ ਵਿੱਚ ਹੋਊਗਾ ਉਹ ਤਾਂ ਬਕਸਾ ਬੰਦ ਬਣ ਹੀ ਜਾਣਾ ਬਕਸਾ ਫਿਰ ਮਤਲਬ ਸਾਰਾ ਕਿੰਨਾ ਕੁ ਖੱਟਾ ਆਜਗਾ ਸਣੇ ਗੱਦਾ ਤੇ ਸਾਰਾ ਢੋ ਤੇ ਬੈਡ ਦੇ ਵਿੱਚ ਦਾ ਪੰਦਰਾਂ ਹਜ਼ਾਰ ਚ ਕਿੰਨੇ ਕੁ ਟਾਈਮ ਚ ਬਣਾ ਦਿਓ ਠੀਕ ਹੈ ਤੇ ਚਲੋ ਫਿਰ ਮੈਂ ਘਰੇ ਸਲਾਹ ਕਰਕੇ ਤੇ ਫਿਰ ਮੈਂ ਆ ਕੇ ਵੇਖਦਾ ਸਰਮਾਕਾ ਦਾ ਰੰਗ ਪਸੰਦ ਕਰ ਜਾਵਾਂਗੀ ਹਾਂ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ